ਅੰਮ੍ਰਿਤਸਰ ਅਤੇ ਬਾਘਾ ਬਾਰਡਰ ਇੱਕ ਟੂਰਿਸਟ ਪਲੇਸ ਆ ਵੱਖ ਵੱਖ ਤਰ੍ਹਾਂ ਦੇ ਪਰ ਧਰਮ ਦੇ ਲੋਕ ਇੱਥੇ ਆਉਂਦੇ ਆ ਅਤੇ ਇੱਥੇ ਆਉਣ ਅਤੇ ਨਾਲ ਇੱਥੇ ਹੀ ਵੱਸ ਜਾਂਦੇ ਹਨ ਅਤੇ ਉਹਨਾਂ ਦੀਆਂ ਵੱਖ ਵੱਖ ਭਾਸ਼ਾਵਾਂ ਹੋਣ ਦੇ ਕਾਰਨ ਅ ਵੱਖ ਵੱਖ ਧਰਮਾਂ ਦੇ ਲੋਕ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਦੇ ਆ ਅਤੇ ਉਹ ਭਾਸ਼ਾ ਜਿਹੜੀ ਆ ਲੋਕਾਂ ਵਿੱਚ ਜ਼ਿਆਦਾ ਜ਼ਿਆਦਾ ਬੋਲੀ ਜਾਂਦੀ ਆ ਅਤੇ ਪੰਜਾਬੀ ਹਿੰਦੀ ਮਰਾਠੀ ਸਾਰੇ ਤਰ੍ਹਾਂ ਦੀ ਭਾਸ਼ਾ ਦੇ ਲੋਕ ਇੱਥੇ ਲਾ ਆਸ ਪਾਸ ਰਹਿੰਦੇ ਹਨ ਅਤੇ ਜਿਹੜੇ ਬੜੇ ਪਿਆਰ ਦੇ ਨਾਲ ਰਹਿੰਦੇ ਹਨ ਅੰਮ੍ਰਿਤਸਰ ਵਿੱਚ ਅਤੇ ਉਹਨਾਂ ਦਾ ਇੱਥੇ ਵ ਵਧੀਆ ਤਰ੍ਹਾਂ ਦਾ ਜੀਵਨ ਰ ਰਹਿਣ ਦਾ ਹੈਗਾ ਹੈ ਅਤੇ ਉਹ ਇੱਥੇ ਹੋਣ ਦੇ ਕਾਰਨ ਉਹਨਾਂ ਨੂੰ ਇੱਥੇ ਵ ਇੱਥੇ ਰਹਿਣ ਦਾ ਅਤੇ ਉਹਨਾਂ ਦਾ ਦ ਕ ਇੱਥੇ ਕਲਚਰ ਅਤੇ ਉਹ ਵੱਖ ਵੱਖ ਤਰ੍ਹਾਂ ਦੇ ਖਾਣੇ ਅਤੇ ਹੋਰ ਕਈ ਤਰ੍ਹਾਂ ਦੇ ਟਰਡੀਸ਼ਨਲ ਕਰਕੇ ਅੰਮ੍ਰਿਤਸਰ ਵਿੱਚ ਲੋਕਾਂ ਦਾ ਟੇਸਟ ਉਨ੍ਹਾਂ ਦੇ ਕ ਉਹਨਾਂ ਦੀ ਜਿਹੜੀ ਟੇਸਟ ਇੱਥੇ ਆਉਣ ਕਰਕੇ ਲੋਕਾਂ ਦੀ ਵ ਵ ਵੰਨ ਸਵੰਨੀ ਟੇਸਟ ਵ ਕ ਅ ਅ ਕਰਦੇ ਆ ਅਤੇ ਹਰ ਇੱਕ ਤਰ੍ਹਾਂ ਦੀਆਂ ਉਹ ਨਾਲੇ ਜਾਤਾਂ ਦੇ ਧਰਮ ਜਿਹੜੇ ਆ ਉਹ ਉਹਨਾਂ ਵਿੱਚ ਸਾਰਿਆਂ 'ਚ ਇੰਨਾ ਵਧੀਆ ਪਿਆਰ ਆ ਅਤੇ ਰਹਿਣ ਦਾ ਸਤਿਕਾਰ ਕਰਦੇ ਇੱਕ ਦੂਜੇ ਨੂੰ